ਗ੍ਰਹਿ ਪ੍ਰਣਾਲੀਆਂ ਦੇ ਵਿਕਾਸ ਦੀ ਸਥਿਤੀ ਕਾਫੀ ਹੱਦ ਤੱਕ ਚੰਗੀ ਹੋ ਗਈ ਹੈ ਅਤੇ ਸਾਡੀ ਸਮਝ ਵੀ ਇਹਨਾਂ ਦੇ ਗਠਨ ਬਾਰੇ ਕਾਫੀ ਵੱਧ ਚੁੱਕੀ ਹੈ ਅਗਰ ਗੱਲ ਕੀਤੀ ਜਾਵੇ ਸਰਗਰਮ ਖੋਜ ਦੀ ਤਾਂ ਭਾਰਤ ਵੱਲੋਂ ਲੋਂਚ ਕੀਤਾ ਗਿਆ ਚੰਦਰਯਾਨ ਟੂ ਸਫਲਤਾ ਤਰੀਕੇ ਦੇ ਨਾਲ ਚੰਨ 'ਤੇ ਲੈਂਡ ਕੀਤਾ ਚੰਨ 'ਤੇ ਲੈਂਡਿੰਗ ਦੇ ਕਾਰਨ ਵਿਗਿਆਨੀਆਂ ਨੇ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਦੀ ਖੋਜ ਕੀਤੀ ਭਾਰਤ ਨੇ ਇੱਕ ਬਹੁਤ ਹੀ ਚੰਗਾ ਮੁਕਾਮ ਹਾਸਿਲ ਕੀਤਾ ਸਫਲਤਾ ਤੌਰ 'ਤੇ ਇਸ ਦੀ ਲੈਂਡਿੰਗ ਕਰਵਾ ਕੇ ਵਿਗਿਆਨੀਆਂ ਵੱਲੋਂ ਕੀਤੀ ਗਈ ਇਸ ਖੋਜ ਕਾਰਨ ਵੀ ਵਿਗਿਆਨੀਆਂ ਨੂੰ ਵੀ ਕਾਫੀ ਪ੍ਰਸ਼ੰਸਾ ਮਿਲੀ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਨਵੀਂ ਖੋਜ ਦੇ ਬਾਰੇ ਤਾਂ ਵਿਗਿਆਨੀ ਹਜੇ ਤੱਕ ਚੰਗੇ ਤਰੀਕੇ ਨਾਲ ਬਲੈਕ ਹੋਲ ਦੇ ਬਾਰੇ ਖੋਜ ਨਹੀਂ ਕਰ ਸਕੇ ਅਤੇ ਇਸਦੀ ਖੋਜ ਵੀ ਚੱਲ ਰਹੀ ਹੈ ਇਸ ਤੋਂ ਇਲਾਵਾ ਵੀ ਭਾਰਤ ਦੇ ਵਿਗਿਆਨੀਆਂ ਦਾ ਸੁਪਨਾ ਹੈ ਸੂਰਜ ਤੱਕ ਪਹੁੰਚਣ ਦਾ ਇਸਦੇ ਨਾਲ ਸੰਬੰਧਿਤ ਕਾਫੀ ਪ੍ਰੋਜੈਕਟ ਚੱਲ ਰਹੇ ਹਨ ਅਤੇ ਹੋਰ ਗ੍ਰਹਿਆਂ ਦੀ ਜਾਣਕਾਰੀ ਪਤਾ ਕਰਨ ਦੇ ਲਈ ਕਿ ਕਿੱਥੇ ਮਨੁੱਖੀ ਜੀਵਨ ਸੰਭਵ ਹੈ ਇਸ ਦੀ ਜਾਣਕਾਰੀ ਦੇ ਲਈ ਵੀ ਵਿਗਿਆਨੀਆਂ ਵੱਲੋਂ ਖੋਜ ਕੀਤੀ ਜਾ ਰਹੀ ਹੈ